ਸਤਾਸੀ ਅੱਠ ਸੌ ਅਠਾਨਵੇਂ ਦੋ ਹਜ਼ਾਰ ਨੌਂ ਸੌ ਉਣਾਨਵੇਂ ਉਣਾਹਠ ਹਜ਼ਾਰ ਅੱਠ ਸੌ ਸਤਾਨਵੇਂ ਨੌਂ ਲੱਖ ਚੌਂਹਠ ਹਜ਼ਾਰ ਸੱਤ ਸੌ ਅਠਾਨਵੇਂ